ਹਲੋ ਹਾਂਜੀ ਵਧੀਆ ਜੀ ਵਾਲੀਆ ਸਾਹਿਬ ਤੁਸੀਂ ਸੁਣਾਓ ਵਧੀਆ ਸਭ ਘਰ ਬਾਹਰ ਸਭ ਵਧੀਆ ਜੀ ਤੁਸੀਂ ਸੁਣਾਓ ਬੱਚੇ ਲੈਫ ਦੇ ਰਿਗਾਡਿੰਗ ਗੱਲ ਕਰਨ ਲਈ ਫ਼ੋਨ ਕੀਤਾ ਮੈਂ ਆਪਣਾ ਕਾਕਾ ਹੈ ਨਾ ਜੀ ਵੈਭਵ ਉਹਦਾ ਸਕੂਲ 'ਚ ਐਡਮੀਸ਼ਨ ਕਰਾਵਾਉਣਾ ਹੈ ਓ ਲੈ ਬਿਲਕੁਲ ਜੀ ਬਿਲਕੁਲ ਤਾਂ ਦੱਸੋ ਫ਼ਿਰ ਆਪਾਂ ਕਿੱਦਾਂ ਕਰੀਏ ਓਸ 'ਚ ਪਾ ਦਿੰਦੇ ਹੈ ਫ਼ਿਰ ਕਿਉਂ ਕੀ ਹੋਇਆ ਜੀ ਅੱਛਾ ਅੱਛਾ ਹਾਂ ਹਾਂ ਅੱਛਾ ਅੱਛਾ ਫਿਰ ਤਾਂ ਕੀ ਫ਼ਾਇਦਾ ਹੈ ਯਾਰ ਇਹੋ ਜਿਹੇ ਸਕੂਲ ਦਾ ਹਾਂ ਅੱਛਾ ਅੱਛਾ ਕਿਹੜੇ ਸਕੂਲ ਲਾਈਏ ਫਿਰ ਡੀ ਏ ਡੀ ਪੀ ਐੱਸ ਵੀ ਹੈਗਾ ਨਾ ਡੀ ਪੀ ਐੱਸ ਹੈਗਾ ਉਹਦਾ ਵੀ ਅੱਜ ਕੱਲ੍ਹ ਬੜਾ ਨਾਮ ਹੈ ਹਾਂਜੀ ਹਾਂ ਪੈਸਾ ਤਾਂ ਹੈ ਜ਼ਿਆਦਾ ਚਲੋ ਪੈਸਾ ਤਾਂ ਜ਼ਿਆਦਾ ਹੈ ਵੱਧ ਹੀ ਹੈ ਉਸ ਤੋਂ ਵੀ ਹਾਂਜੀ ਹਾਂ ਹੂੰ ਹੂੰ ਨਹੀਂ ਇਹ ਤਾਂ ਹੈ ਹਾਂ ਚੱਲ ਮੈਂ ਦੇਖਿਆ ਉੱਦਾਂ ਵੀ ਵਾਧੂ ਸ਼ੋਸ਼ਾ ਏ ਸੀ ਵਗੈਰਾ ਲਗਾਏ ਹੋਏ ਹੈ ਜ਼ਿਆਦਾ ਇਨ੍ਹਾਂ ਬੱਚਿਆਂ ਨੂੰ ਨਾ ਜ਼ਿਆਦਾ ਪੈਂਪਰ ਵੀ ਨਹੀਂ ਕਰਨਾ ਚਾਹੀਦਾ ਵਿਗੜਦੇ ਹੀ ਹੈ ਨਹੀਂ ਤਾਂ ਫਿਰ ਆਪਾਂ ਕਿਹੜਾ ਸਕੂਲ ਦੇਖੀਏ ਨਹੀਂ ਨਹੀਂ ਫਿਰ ਆਪਾਂ ਸਕੂਲ ਤਾਂ ਦੇਖੋ ਦੱਸੋ ਕਿੱਦਾਂ ਕਰੀਏ ਫਿਰ ਅੱਛਾ ਉਹ ਤਾਂ ਵਧੀਆਂ ਹੈ ਕਾਫ਼ੀ ਪੁਰਾਣਾ ਸਕੂਲ ਹੈ ਆਪਣਾ ਹਾਂਜੀ ਹਾਂਜੀ ਇਹਦਾ ਮੈਂ ਸੁਣਿਆ ਫ਼ੀਸ ਵਗੈਰਾ ਵੀ ਜੈਨੂਅਨ ਜਿਹੀ ਹੈ ਹਾਂ ਹਾਂ ਹਾਂ ਹਾਂ ਹਾਂ ਸਹੀ ਗੱਲ ਹੈ ਇਹ ਤਾਂ ਅੱਛਾ ਫ਼ੀਸ ਤਾਂ ਸਹੀ ਗੱਲ ਹੈ ਫ਼ੀਸ ਜੈਨੂਅਨ ਹੋਵੇ ਫਿਰ ਤਾਂ ਸਕੂਲ ਦੇ ਟੀਚਰ ਵਧੀਆ ਹੋਣ ਹੋਰ ਸਾਨੂੰ ਕੀ ਚਾਹੀਦਾ ਮੈਂ ਸੁਣਿਆ ਖੇਡਾਂ ਵਗੈਰਾ ਦਾ ਵੀ ਹੈਗਾ ਵਧੀਆ ਹੂੰ ਹੂੰ ਖੇਡਾਂ ਵਗੈਰਾ ਦਾ ਵੀ ਵਧੀਆ ਬਿਲਕੁਲ ਬਿਲਕੁਲ ਅਤੇ ਮੈਂ ਸੁਣਿਆ ਟੀਚਰ ਵਗੈਰਾ ਵੀ ਵਧੀਆ ਹੀ ਨੇ ਅਤੇ ਹੂੰ ਅੱਛਾ ਅਤੇ ਆਪਾਂ ਕੀ ਕਹਿੰਦੇ ਹੈ ਤੁਹਾਨੂੰ ਪਤਾ ਹੈ ਐਡਮੀਸ਼ਨ ਵਗੈਰਾ ਕਦੋਂ ਤੋਂ ਸ਼ੁਰੂ ਹੋਣੀ ਅਤੇ ਆਪਾਂ ਕਿੱਦਾਂ ਕਰਨੀ ਆ ਅੱਛਾ ਤਾਂ ਅਡਮੀਸ਼ਨ ਲਈ ਆਪਾਂ ਨੂੰ ਕੀ ਕੀ ਦੇਣਾ ਹੈ ਡੌਕੂਮੈਂਟ ਵਗੈਰਾ ਅੱਛਾ ਅੱਛਾ ਠੀਕ ਹੈ ਅੱਛਾ ਅੱਛਾ ਚਲੋ ਉਹ ਤਾਂ ਹੋਜੂਗਾ ਉਹ ਨਹੀਂ ਔਖਾ ਹਾਂਜੀ ਬਣ ਜੂਗੀ ਬਣ ਜੂਗੀ ਹਾਂਜੀ ਠੀਕ ਐ ਹੂੰ ਹੂੰ ਹੂੰ ਅੱਛਾ ਅਤੇ ਇਹ ਲਿਸਟ 'ਚ ਨਾਮ ਕਿੱਦਾਂ ਕੋਈ ਇਹਨਾਂ ਨੇ ਟੈਸਟ ਟੁਸਟ ਲੈਣਾ ਹੈ ਕਿੱਦਾਂ ਅ ਅੱਛਾ ਸਾਡਾ ਵੀ ਲੈਣਗੇ ਠੀਕ ਹੈ ਜੀ ਚਲੋ ਉਹ ਤਾਂ ਆਪਣੇ ਬੱਚੇ ਹੁਸ਼ਿਆਰ ਹੀ ਹੈ ਕਰ ਲੈਣਗੇ ਕਲੀਅਰ ਉਹ ਦਾ ਨਹੀਂ ਚੱਕਰ ਚਲੋ ਜੀ ਕੋਈ ਚੱਕਰ ਨਹੀਂ ਜੀ ਅਸੀਂ ਤੁਸੀਂ ਕਹਿ ਤਾਂ ਅਸੀਂ ਬਿਲਕੁਲ ਨਿਸ਼ਚਿੰਤ ਹੈ ਜੀ ਹੋਰ ਸੁਣਾਓ ਚਲੋ ਠੀਕ ਹੈ ਜੀ ਚੰਗਾ ਫਿਰ ਓਕੇ ਓਕੇ